ਮੈਂ ਸਕੂਲ ਟਾਈਮ ਤੋਂ ਬਚਪਨ ਤੋਂ ਹੀ ਡਰਾਇੰਗ ਦਾ ਮੈਨੂੰ ਸ਼ੌਂਕ ਸੀ ਅਤੇ ਉਸ ਵਕਤ ਸਕੈਚ ਬਣਾਏ ਜਾਂਦੇ ਸੀ ਸਕੈਚ ਤੋਂ ਹੀ ਕਲਰ ਭਰਨੇ ਅਤੇ ਕਲਰਸ ਨਾਲ ਕਲਰ ਦੇਖਣਾ ਬੜਾ ਪਸੰਦ ਸੀ ਜਿਹਨਾਂ ਦੇ ਨਾਲ ਮੈਨੂੰ ਡਰਾਇੰਗ ਦਾ ਸ਼ੌਂਕ ਹੋਰ ਵੱਧ ਗਿਆ ਅਤੇ ਟੀਚਰਸ ਵੀ ਅੱਛਾ ਗਾਈਡ ਕਰਦੇ ਸੀ ਸਕੈਚ ਬਣਾਉਂਦੇ ਸੀ ਅਤੇ ਡਰਾਇੰਗ ਵੀ ਅੱਛੀ ਜਾਂਦੀ ਸੀ ਮੇਰੀ ਜਿਹਦੇ ਨਾਲ ਮੈਨੂੰ ਕਲਰ ਭਰਨੇ ਹੋਰ ਅੱਛੇ ਲੱਗਣ ਲੱਗ ਪਏ ਸਕੈਚ ਵੀ ਅੱਛੇ ਬਣਾ ਸੀ ਮੇਰੀ ਸਫਾਈ ਸੀ ਚੀਜ਼ ਨੂੰ ਬਣਾਉਣ ਵਿੱਚ ਜਿਹਦੇ ਨਾਲ ਮੈਨੂੰ ਹੋਰ ਸ਼ੌਂਕ ਪੈ ਗਿਆ ਟੀਚਰ ਬਹੁਤ ਐਪਰੀਸ਼ੀਏਟ ਕਰਦੇ ਸੀ ਮੇਰੀ ਡਰਾਇੰਗ ਨੂੰ ਟੀਚਰ ਨੇ ਮੈਨੂੰ ਹੋਰ ਪੁੱਸ਼ ਅਪ ਦਿੱਤਾ ਅਤੇ ਮੈਨੂੰ ਬਹੁਤ ਅੱਛਾ ਲੱਗਦਾ ਸੀ ਡਰਾਇੰਗ ਕਰਨਾ ਅਤੇ ਡਰਾਇੰਗ ਅੱਜ ਮੈਂ ਅੱਜ ਵੀ ਉਸੇ ਤਰ੍ਹਾਂ ਹੀ ਡਰਾਇੰਗ ਕਰ ਰਹੀ ਹਾਂ ਮੈਨੂੰ ਬਹੁਤ ਅੱਛਾ ਲੱਗਦਾ ਡਰਾਇੰਗ ਨੂੰ ਕਲਰ ਭਰਨਾ ਸਕੈਚ ਕਰਨਾ ਅਲੱਗ ਅਲੱਗ ਟਾਈਪ ਦੀਆਂ ਮੈਂ ਡਰਾਇੰਗ ਕਰਦੀ ਹਾਂ ਅਤੇ ਟੀਚਰ ਦਾ ਟੀਚਰ ਨੇ ਇਸ ਚੀਜ਼ ਨੂੰ ਬਹੁਤ ਐਪਰੀਸ਼ੀਏਟ ਕੀਤਾ